ਮੈਂ ਰਾਕੇਸ਼ ਸੁਜਾਨਪੁਰ ਦੀ ਰਹਿਣ ਵਾਲੀ ਜ਼ਿਲ੍ਹਾ ਪਠਾਨਕੋਟ ਮੈਂ ਆਪਣੇ ਰਾਜ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਮੈਂ ਪੰਜਾਬ ਰਾਜ ਦੀ ਵਸਨੀਕ ਹਾਂ ਔਰ ਮੇਰੇ ਸਮਾਜ ਦੇ ਸਬ ਸੱਭਿਆਚਾਰਕ ਪਰੰਪਰਾਗਤ ਪਹਿਰਾਵੇ ਕੱਪੜੇ ਗਹਿਣਿਆਂ ਬਾਰੇ ਤੁਹਾਨੂੰ ਕੀ ਹੈ ਅੱਜ ਦੱਸਣਾ ਚਾਹਾਂਗੀ ਮੇਰਾ ਸੱਭਿਆਚਾਰ ਜੋ ਹੈ ਉਹ ਉਸ ਦੀ ਝਲਕ ਜੋ ਹੈ ਉਹ ਸਾਡੇ ਕੱਪੜਿਆਂ ਤੋਂ ਸਾਡੇ ਗਹਿਣਿਆਂ ਤੋਂ ਸਾਡੇ ਪਹਿਰਾਵੇ ਤੋਂ ਸਾਡੀ ਬੋਲੀ ਤੋਂ ਹਰ ਜਗ੍ਹਾ ਤੋਂ ਕੀ ਹੈ ਚਾਂਦ ਪਵਾਉਂਦੀ ਹੈ ਜਿਵੇਂ ਕਿ ਕਿਸੇ ਸਮਾਜ ਦਾ ਜੋ ਅਗਰ ਅਸੀਂ ਦੇਖਣਾ ਹੋਵੇ ਸੱਭਿਆਚਾਰ ਤਾਂ ਉਸਦੇ ਅਸੀਂ ਮੇਲੇ ਵਿੱਚੋਂ ਦੇਖ ਸਕਦੇ ਹਾਂ ਚੱਲਦਾ ਫਿਰਦਾ ਜਿਹੜਾ ਮੇਲਾ ਹੈ ਉਹ ਸੱਭਿਆਚਾਰ ਦਾ ਇੱਕ ਰ ਅੰਗ ਹੁੰਦਾ ਹੈ ਅਤੇ ਸਾਨੂੰ ਦਿਖਾਉਂਦਾ ਹੈ ਕਿ ਕਿਵੇਂ ਮੇਲੇ ਦੇ ਵਿੱਚ ਲੋਕ ਜੋ ਹੈ ਕੱਪੜੇ ਪਾ ਕੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਕੱਪੜੇ ਪਾ ਕੇ ਗਹਿਣੇ ਪਾ ਕੇ ਅਤੇ ਪਰੰਪਰਾਗਤ ਪਹਿਰਾਵੇ ਨੂੰ ਪਹਿਨ ਕੇ ਜਦੋਂ ਉਹ ਮੇਲਿਆਂ ਦੇ ਸ਼ੌਕੀ ਮੇਲਿਆਂ ਦੇ ਵਿੱਚ ਨਿਕਲਦੇ ਹਨ ਤਾਂ ਸਾਨੂੰ ਪੰਜਾਬੀ ਸੱਭਿਆਚਾਰ ਜਿਹੜਾ ਹੈ ਉਹ ਆਪਣੇ ਆਪ ਹੀ ਉੱਥੇ ਦਿੱਖ ਜਾਂਦਾ ਹੈ ਅਤੇ ਇਹ ਸਾਡੇ ਖੇਤਰ ਦੇ ਜਿਹੜੇ ਭਾਈਚਾਰੇ ਦਾ ਇੱਕ ਵੱਖਰਾਪਣ ਜੋ ਹੈ ਉੱਥੇ ਜਿਹੜਾ ਨਜ਼ਰ ਆ ਜਾਂਦਾ ਹੈ